ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਜ਼ਰੂਰ ਪਾਇਆ ਜਾਂਦਾ ਹੈ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਜਿੱਥੇ ਵ ਕਿਤੇ ਵੀ ਪੰਜਾਬੀ ਵਸਦੇ ਹਨ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਭੰਗੜਾ ਨਾ ਪਾਇਆ ਜਾਵੇ ਪੰਜਾਬ ਭੰਗੜਾ ਪੰਜਾਬ ਦੇ ਕਿਸਾਨ ਵੱਲੋਂ ਫਸਲ ਪੱਕਣ ਦੀ ਖੁਸ਼ੀ ਦੀ ਵਿਸਾਖੀ ਤਿਉਹਾਰ 'ਤੇ ਵੀ ਪਾਇਆ ਜਾਂਦਾ ਹੈ ਭੰਗੜੇ ਦੇ ਪ੍ਰਦਰਸ਼ਨ ਲਈ ਚਾਦਰੇ ਨਾਲ ਕੁੜਤੇ ਪਾਏ ਜਾਂਦੇ ਹਨ ਉੱਪਰ ਦੀ ਜੈਕਟ ਪਾਈ ਜਾਂਦੀ ਹੈ ਉਹ ਕੈਂਠੇ ਕੰਨਾਂ ਵਿੱਚ ਨੱਤੀਆਂ ਨੌਕ ਵਾਲੀ ਜੁੱਤੀ ਪੱਗ ਵਿੱਚ ਘੁੰਗਰੂ ਪਰਲੇ ਵਾਲੇ ਪ ਪੱਗ ਬੰਨ੍ਹੀ ਜਾਂਦੇ ਹਨ ਉਹਨਾਂ ਨੂੰ ਪ੍ਰਸ਼ਾਸਨ ਲਈ ਖਾਸ ਪਹ ਪਹਿਰਾਵਾ ਪਾਉਣ ਲਈ ਪਾਉਣਾ ਪੈਂਦਾ ਹੈ ਇਹ ਪਹਿਰਾਵਾ ਉਹਨਾਂ ਦੇ ਹਰ ਹੋਰ ਆਦਰਸ਼ ਬਣਾਉਂਦਾ ਹੈ ਭੰਗੜਾ ਗੱਭਰੂਆਂ ਅਤੇ ਮੁਟਿਆਰਾਂ ਦੋਨਾਂ ਦੁਆਰਾ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਦਾ ਮੁੱਖ ਨਾਚ ਹੈ ਭੰਗ